ਹੈਲੋ ਗੁੱਡ ਈਵਨਿੰਗ ਸਰ ਹਾਂਜੀ ਸਰ ਕਿਵੇਂ ਹਾਲ ਚਾਲ ਹਾਂਜੀ ਸਰ ਆਪਾਂ ਸਾਰਾ ਦਿਨ ਕੰਮ ਕਾਰ 'ਚ ਰੁੱਝੇ ਰਹਿੰਦੇ ਹਾਂ ਕਿਉਂ ਨਾ ਆਪਾਂ ਕੱਲ੍ਹ ਮੂਵੀ ਵੇਖ ਕੇ ਆਈਏ ਸਰ ਕਿਹੜੇ ਕਿਹੜੇ ਕਿਹੜੀ ਫਿਲਮ ਦੀ ਅੱਛਾ ਬੋਲੀਵੁੱਡ

ਹਾਂਜੀ ਹਾਂਜੀ ਸਰ ਇਹ ਬ ਬੜਾ ਵਧੀਆ ਐਕਸਪੀਰੀਅਂਸ ਰਹੇਗਾ ਹੈ ਨਾ ਸਰ ਹਾਂ ਹਾਂ ਸਰ ਫਿਰ ਠੀਕ ਹੈ ਆਪਾਂ ਚਲਦੇ ਹਾਂ ਆਪਾਂ ਆਪਣੇ ਪਰਿਵਾਰਾਂ ਨੂੰ ਵੀ ਲੈ ਚੱਲਾਂਗੇ ਸਰ ਬੜਾ ਮਜ਼ਾ ਆਏਗਾ ਸਰ ਤੁਸੀਂ ਵੀ ਆਪਣੇ ਫੈਮਿਲੀ ਨੂੰ ਤਿਆਰ ਰੱਖਿਓ ਕਦੋਂ ਤੱਕ ਸਰ ਹੈਗੀ ਹੈ ਇਹ ਕਦੋਂ ਤੱਕ ਹੈਗੀ ਸ਼ੂਟਿੰਗ ਸਰ ਫਿਰ ਆਪਾਂ ਸੰਡੇ ਦਾ ਕੰਮ ਰੱਖਦੇ ਹਾਂ ਪ੍ਰੋਗਰਾਮ ਠੀਕ ਹੈ ਸਰ ਹਾਂ ਹਾਂਜੀ ਠੀਕ ਹੈ ਸਰ ਠੀਕ ਹੈ ਫਿਰ ਆਪਾਂ ਸੰਡੇ ਨੌ ਵਜੇ ਦਾ ਫਿਕਸ ਕਰਦੇ ਹਾਂ ਠੀਕ ਆ ਸਰ ਹਾਂ ਓਕ ਹਾਂ ਓਕੇ ਸਰ ਬਾਏ ਸਰ